ਹਾਂਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਹੈ ਹਾਂਜੀ ਵਧੀਆ ਅਸੀਂ ਵਿਹਲੇ ਜੀ ਹਾਂ ਪਟਿਆਲੇ ਦੇ ਬੜੇ ਬੈਸਟ ਸਕੂਲ ਨੇ ਜਿਹਦੇ ਵਿੱਚ ਬੁੱਢਾ ਦਲ ਪਬਲਿਕ ਸਕੂਲ ਹੈ ਉਹ ਕਾਫ਼ੀ ਵਧੀਆ ਹੈ ਉੱਥੋਂ ਦਾ ਸਟਾਫ ਵੀ ਬੜਾ ਵਧੀਆ ਹੈ ਸਾਰੇ ਵੈੱਲ ਐਜੂਕੇਟਿਡ ਨੇ ਅਤੇ ਉਹਨਾਂ ਦੇ ਬੱਚੇ ਜਿਹੜੇ ਨੇ ਨੈਸ਼ਨਲ ਲੈਵਲ 'ਤੇ ਵੀ ਖੇਡ ਚੁੱਕੇ ਨੇ ਪੜ੍ਹਾਈ ਦੇ ਨਾਲ ਨਾਲ ਉਹ ਸਟ ਮਤਲਬ ਹੋਰ ਵੀ ਚੀਜ਼ਾਂ ਸਪੋਰਟਸ ਦੇ ਵਿੱਚ ਬਹੁਤ ਅੱਗੇ ਨੇ ਕੋਕਰੀਕੁਲਮ ਐਕਟਿਵੀਜ਼ ਵੀ ਕਰਵਾਉਂਦੇ ਨੇ ਆਪਣੇ ਪਟਿਆਲੇ ਦੇ ਵਿੱਚ ਬਹੁਤ ਨਾਮ ਹੈ ਇਵਨ ਕਿ ਪਟਿਆਲੇ 'ਚ ਨਹੀਂ ਪੂਰੇ ਪੰਜਾਬ 'ਚ ਹੀ ਅਤੇ ਉਸ ਤੋਂ ਬਾਅਦ ਆ ਜਾਂਦਾ ਵਾਈ ਪੀ ਐਸ ਉਹ ਵੀ ਕਾਫ਼ੀ ਫੇਮਸ ਹੈ ਤੇ ਮਤਲਬ ਠੀਕ ਹੈ ਉੱਥੇ ਇੱਕ ਵਾਰ ਬੱਚਾ ਜਾ ਕੇ ਕੁਛ ਨਾ ਕੁਛ ਬਣ ਕੇ ਹੀ ਬਾਹਰ ਨਿਕਲਦਾ ਅਤੇ ਲੇਡੀ ਫਾਤਿਮਾ ਹੈ ਉਹ ਵੀ ਬਹੁਤ ਵਧੀਆ ਸਕੂਲ ਹੈ ਉੱਥੇ ਵੀ ਬੱਚੇ ਜਾ ਕੇ ਇੱਕ ਵਾਰ ਮਤਲਬ ਬਸ ਆਪਾਂ ਐਡਮਿਸ਼ਨ ਹੀ ਕਰਵਾਉਣੀ ਹੈ ਉਸ ਤੋਂ ਬਾਅਦ ਬੱਚਾ ਬਹੁਤ ਵਧੀਆ ਤਰੱਕੀ ਕਰ ਜਾਂਦਾ ਬੜੇ ਟੀਚਰ ਬੜੇ ਵਧੀਆ ਨੇ ਪੜ੍ਹਾਉਣ ਦੇ ਵਿੱਚ ਮਾਹਿਰ ਨੇ ਅਤੇ ਇਹਦੇ ਨਾਲ ਨਾਲ ਹੋਰ ਵੀ ਹੈ ਇੱਥੇ ਡੀ ਏ ਵੀ ਸਕੂਲ ਵੀ ਵਧੀਆ ਉੱਥੋਂ ਦਾ ਅਤੇ ਡੀ ਪੀ ਐਸ ਵੀ ਹੈਗਾ ਉੱਥੇ ਡੀ ਪੀ ਐਸ ਦੇ ਤੁਹਾਨੂੰ ਪਤਾ ਹੀ ਸਾਰੇ ਕਿਤੇ ਉਹਦੀਆਂ ਬਰਾਂਚਿਸ ਨੇ ਅਤੇ ਵਧੀਆ ਵਧੀਆ ਤਰੀਕੇ ਨਾਲ ਕਾਫ਼ੀ ਵਧੀਆ ਹੈ ਮਤਲਬ ਉੱਥੇ ਦੇ ਜਿਹੜਾ ਸਟਾਫ ਹੈ ਕੋਆਪਰੇਟਿਵ ਵੀ ਹੈ ਮੈਂ ਉਹਨਾਂ ਦੇ ਨਾਲ ਇੱਕ ਦੋ ਵਾਰ ਮਿਲੀ ਵੀ ਹਾਂ ਕਾਫ਼ੀ ਅਤੇ ਉਹਨਾਂ ਦੇ ਬੱਚੇ ਵੀ ਇੰਟਰਨੈਸ਼ਨਲ ਲੈਵਲ ਤੱਕ ਜਾਂਦੇ ਨੇ ਅਤੇ ਪੜ੍ਹਾਈ ਵੀ ਬਹੁਤ ਅੱਛੀ ਹੈ ਅਤੇ ਨਾਲ ਨਾਲ ਉਹ ਖੇਡਾਂ 'ਚ ਵੀ ਲੈ ਕੇ ਜਾਂਦੇ ਨੇ ਬੱਚਿਆਂ ਨੂੰ ਹੋਰ ਕ ਕੋਕਰੀਕੁਲਮ ਐਕਟਿਵੀਜ਼ ਜਿਵੇਂ ਆ ਕਲਚਰਲ ਐਕਟੀਵਿਟੀਜ਼ ਦੇ ਵਿੱਚ ਵੀ ਕਾਫ਼ੀ ਅੱਗੇ ਨੇ ਅਤੇ ਮਤਲਬ ਇਹ ਜਿਹੜੇ ਸਕੂਲ ਨੇ ਨਾਲ ਵਾਈ ਪੀ ਐਸ ਹੋ ਗਿਆ ਬੁੱਢਾ ਦਲ ਪਬਲਿਕ ਸਕੂਲ ਹੋ ਗਿਆ ਲੇਡੀ ਫਾਤਿਮਾ ਇਹ ਕਾਫ਼ੀ ਵਧੀਆ ਨੇ ਅਤੇ ਡੀ ਪੀ ਐਸ ਵੀ ਬਹੁਤ ਵਧੀਆ ਮਤਲਬ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਚੂਜ ਕਰ ਸਕਦੇ ਹੋ ਅਤੇ ਹਾਂਜੀ ਹਾਂਜੀ ਹਾਂ ਉਹਨਾਂ ਦੇ ਸਵੇਰੇ ਨੌਂ ਵਜੇ ਤੋਂ ਦੋ ਵਜੇ ਤੱਕ ਦੀ ਟਾਈਮਿੰਗ ਹੈ ਬਾਕੀ ਟੀਚਰਸ ਲਈ ਥੋੜ੍ਹੀ ਅਲੱਗ ਹੁੰਦੀ ਹੈ ਬੱਚਿਆਂ ਦੀ ਤਾਂ ਸਹੀ ਹੈ ਅਤੇ ਉਹਦੇ ਵਿੱਚ ਹੀ ਵਧੀਆ ਹੋ ਜਾਂਦਾ ਹਾਂਜੀ ਠੀਕ ਹੈ ਓਕੇ ਜੀ ਧੰਨ